ਸਾਈਕਲ ਚਲਾਉਣ ਲੱਗੇ ਇੱਕ ਤਾਂ ਰਿਫਲੈਕਟਰ ਦੀ ਵਰਤੋਂ ਕਰਨੀ ਜ਼ਰੂਰੀ ਹੁੰਦੀ ਹੈ ਜੇ ਰਾਤ ਸਮੇਂ ਸ ਸਾਈਕਲ ਚਲਾ ਰਹੇ ਹਾਂ ਤਾਂ ਰਿਫਲੈਕਟਰ ਹੋਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਅਉਣ ਵਾਲੇ ਸਾਧਨ ਜਿਹੜੇ ਹੈਗੇ ਹੈ ਉਨ੍ਹਾਂ ਨੂੰ ਆਪਣਾ ਪਤਾ ਲੱਗ ਸਕੇ ਵੀ ਇੱਕ ਸਾਈਕਲ ਜਾ ਰਿਹਾ ਸਾਈਂਕਲ ਨੂੰ ਹਮੇਸ਼ਾ ਸਾਈਡ ਦੇ ਉੱਤੇ ਹੀ ਚਲਾਉਣਾ ਚਾਹੀਦਾ ਹੈ ਇਹ ਹੌਲਾ ਸਾਧਨ ਹੈ ਜੇ ਵੱਡੇ ਸਾਧਨ ਕੋਲ ਦੀ ਲੰਘਣਗੇ ਤਾਂ ਉਹਨੂੰ ਅਫੈਕਟ ਕਰਦੇ ਹਨ ਦਸਤਾਵੇਜ਼ ਜਦੋਂ ਕਿ ਦਸਤਾਵੇਜ਼ ਦੀ ਗੱਲ ਹੈ ਦਸਤਾਵੇਜ਼ ਦੇ ਵਿੱਚ ਆਪਣਾ ਅਧਾਰ ਕਾਰਡ ਵਗੈਰਾ ਜਾਂ ਕੋਈ ਆਈ ਡੀ ਪਰੂਫ ਹੋਣਾ ਜ਼ਰੂਰੀ ਹੁੰਦਾ ਹੈ ਜਿਸ ਨਾਲ ਰੱਬ ਨਾ ਕਰੇ ਕੋਈ ਹਾਦਸਾ ਹੋਏ ਤਾਂ ਬੰਦੇ ਦੀ ਪਛਾਣ ਹੋ ਸਕੇ ਕਿਉਂਕਿ ਸਾਈਕਲ ਦੇ ਕੋਈ ਡਾਕੂਮੈਂਟਸ ਨਹੀਂ ਹੁੰਦੇ ਤਾਂ ਆਪਣੇ ਪਰਸਨਲ ਡਾਕੂਮੈਂਟਸ ਦੇ ਵਿੱਚ ਕੋਈ ਆਈ ਡੀ ਪਰੂਫ ਹੋਣਾ ਜ਼ਰੂਰੀ ਹੁੰਦਾ ਹੈ